ਮੀਡੀਆ ਡੈਮੋਕਰੇਸੀ ਦਾ ਚੌਥਾ ਸਤੰਭ ਮੰਨਿਆ ਗਿਆ ਹੈ ਦੇਸ਼ ਦੀ ਤਰੱਕੀ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸੇ ਤਰ੍ਹਾਂ ਪੰਜਾਬ ਦਾ ਮੀਡੀਆ ਵੀ ਲੋਕਾਂ ਨੂੰ ਜਾਗਰੂਕਤ ਕਰਦਾ ਹੈ ਜਿਹੜਾ ਪੰਜਾਬ ਦੀ ਦਿਹਾਤੀ ਵਿੱਚ ਮੀਡੀਆ ਜੋ ਜੋ ਵੀ ਆਪਣੇ ਭਰਤੀ ਪ੍ਰੋਗਰਾਮ ਕਰਦਾ ਹੈ ਉਸ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਅਤੇ ਲੋਕਾਂ ਨੂੰ ਆਪ ਆਪਣੇ ਮੌਕੇ ਦੀ ਸਰਕਾਰ ਦੀ ਸੱਚਾਈ ਪਤਾ ਲੱਗਦੀ ਹੈ ਜੋ ਵੀ ਨੌਕਰੀਆਂ ਦੇ ਵਾਅਦੇ ਸਰਕਾਰ ਦੁਆਰਾ ਕੀਤੇ ਜਾਂਦੇ ਹਨ ਉਹ ਉਸ ਦਾ ਸਾਰਾ ਰਿਪੋਰਟ ਕਾਰਡ ਮੀਡੀਆ ਆਪਣੇ ਪ੍ਰੋਗਰਾਮਾਂ ਦੇ ਵਿੱਚ ਦਿਖਾਉਂਦਾ ਹੈ ਜਿਸ ਨਾਨਾ ਜਿਸ ਨਾਲ ਲੋਕਾਂ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸੱਚ ਕੀ ਹੈ ਕਿ ਕਿੰਨੀਆਂ ਨੌਕਰੀਆਂ ਲੋਕਾਂ ਨੂੰ ਮਿਲੀਆਂ ਹਨ ਅਤੇ ਕਿੰਨੀਆਂ ਨਹੀਂ ਅਤੇ ਕਿੰਨੀਆਂ ਪੋਸਟਾਂ ਹਜੇ ਖਾਲੀ ਪਈਆਂ ਹਨ ਤਾਂ ਇਸ ਕਰਕੇ ਮੀਡੀਆ ਦਾ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ